ਹਾਂਜੀ ਅਸੀਂ ਜਦੋਂ ਛੋਟੇ ਸੀ ਸਾਡੇ ਸਕੂਲ ਵਿੱਚ ਹੈ ਇੱਕ ਲਾਈਬ੍ਰੇਰੀ ਹੈਗੀ ਸੀ ਬਹੁਤ ਵੱਡੀ ਬਹੁਤ ਵਧੀਆ ਲਾਈਬ੍ਰੇਰੀ ਬਣੀ ਹੋਈ ਸੀ ਉਹਦੇ 'ਚ ਬਹੁਤ ਸਾਰੀਆਂ ਕਿਤਾਬਾਂ ਦਾ ਇਕੱਠ ਸੀ ਅਤੇ ਸਾਨੂੰ ਸ਼ੌਂਕ ਵੀ ਬਹੁਤ ਸੀ ਪੜ੍ਹਨ ਦਾ ਅਸੀਂ ਜਦੋਂ ਸ ਸਾਡਾ ਲਾਈਬ੍ਰੇਰੀ ਵਾਲਾ ਪੀਰੀਅਡ ਆਉਂਦਾ ਸੀਗਾ ਤਾਂ ਅਸੀਂ ਜ਼ਰੂਰ ਜਾਂਦੇ ਸੀ ਪੜ੍ਹਨ ਉਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਦੀਆਂ ਕਿਤਾਬਾਂ ਚੁਟਕਲਿਆਂ ਦੀਆਂ ਕਿਤਾਬਾਂ ਸੀਗੀਆਂ ਜਾਂ ਕੌਮਿਕਸ ਹੁੰਦੀਆਂ ਸੀ ਜਿਵੇਂ ਮੈਂਗਜ਼ੀਨਾਂ ਹੁੰਦੀਆਂ ਸੀਗੀਆਂ ਉਹੀ ਅ ਪੰਜਾਬੀ ਚੁਟਕਲੇ ਹੋ ਗਏ ਜਾਂ ਕੋਈ ਸ਼ਿਕਸ਼ਾ ਦੇਣ ਵਾਲੀਆਂ ਵੀ ਸੀਗੀਆਂ ਉਹਦੇ 'ਚ ਇੱਕ ਚਿੱਤਰਕਾਰੀ ਵਾਲੀਆਂ ਹੁੰਦੀਆਂ ਸੀਗੀਆਂ ਕਾਰਟੂਨ ਵਾਲੀਆਂ ਉਹ ਵੀ ਅਸੀਂ ਬਹੁਤ ਪਸੰਦ ਕਰਦੇ ਸੀ ਉਹ ਮਨ ਨੂੰ ਜਿਵੇਂ ਛੂਹਦੀਆਂ ਸੀ ਜਿਵੇਂ ਬਚਪਨ 'ਚ ਬੱਚਿਆਂ ਨੂੰ ਥੋੜ੍ਹਾ ਜਿਹਾ ਅ ਰੰਗ ਬਰੰਗੀਆਂ ਚੀਜ਼ਾਂ ਪਸੰਦ ਹੁੰਦੀਆਂ ਹੈ ਉਹ ਜਿਵੇਂ ਸਾਨੂੰ ਵਧੀਆ ਲੱਗਦੀਆਂ ਆਪਾਂ ਨੂੰ ਦੇਖ ਕੇ ਆਪਾਂ ਨੂੰ ਆਪਾਂ ਇੰਪ ਉਹਦੇ ਤੋਂ ਇੰਪਰੈਂਸ ਹੋ ਜਾਂਦੇ ਹੈਗੇ ਹਾਂ ਅਤੇ ਬਹੁਤ ਅਸੀਂ ਪੜ੍ਹਦੇ ਸੀਗੇ ਅ ਕੌਮ ਅ ਕੌਮੀਕਸ ਵੀ ਹੁੰਦੀਆਂ ਸੀ ਬਾਕੀ ਕੋਈ ਪੰਜਾਬੀ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਸੀ ਜਿਹੁਦੇ 'ਚ ਕਵਿਤਾਵਾਂ ਹੁੰਦੀਆਂ ਸੀਗੀਆਂ ਜਿਹੜੀ ਆਪਾਂ ਨੂੰ ਅ ਬਹੁਤ ਸ਼ਿਕਸ਼ਾ ਦਿੰਦੀਆਂ ਸੀਗੀਆਂ ਵੀ ਦੇਸ਼ ਵਿੱਚ ਦੇਸ਼ ਵਾਸਤੇ ਦੇਸ਼ ਵ ਦੇਸ਼ ਭਗਤੀ ਦੀ ਸ਼ਿਕਸ਼ਾ ਦਿੰਦੀਆਂ ਸੀ ਆਪਾਂ ਨੂੰ ਵਧੀਆ ਕੰਮ ਕਰੀਏ ਆਪਾਂ ਪੜ੍ਹੀਏ ਲਿਖੀਏ ਕੋਈ ਵਧੀਆ ਅ ਆਪਾਂ ਬਣੀਏ ਕੁਛ ਜਿਹੜਾ ਆਪਾਂ ਦੇਸ਼ ਦੇ ਕੰਮ ਆਈਏ ਇਹੋ ਜਿਹੀਆਂ ਕਹਾਣੀਆਂ ਪੜ੍ਹਦੇ ਸੀ ਅਸੀਂ ਵੀ ਜਿਹੜੀ ਅਸੀਂ ਦੇਸ਼ ਦੇ ਕੰਮ ਆਈਏ ਅਤੇ ਵ ਵਧੀਆ ਕੰਮ ਕਰੀਏ